ਹੈਲੋ ਵਧੀਆ ਜੀ ਵਧੀਆ ਜੀ ਸਰ ਤੁਸੀਂ ਸੁਣਾਓ ਕੌਣ ਬੋਲ ਰਹੇ ਹੋ ਜੀ ਜੀ ਜੀ ਸਰ ਬੋਲੋ ਜੀ ਜੀ ਜੀ ਇਸ ਬਾਰੇ ਸਰ ਇਹ ਹੈ ਵੀ ਦੇਖੋ ਮਤਲਬ ਭ ਭਾਰਤ ਸਰਕਾਰ ਨੇ ਬਹੁਤ ਵੱਡਾ ਇੱਕ ਪੰਜਾਬ ਨੂੰ ਗਿਫਟ ਦਿੱਤਾ ਹੈਗਾ ਸਾਡੇ ਏਰੀਏ ਨੂੰ ਜਿਹੜਾ ਮਾਲਵਾ ਏਰੀਆ ਕੈਂਸਰ ਦੀ ਇੱਕ ਤਰ੍ਹਾਂ ਨਾਲ ਮਤਲਬ ਬੈਲਟ ਹੈਗੀ ਹੈ ਕੈਂਸਰ ਦੀ ਰਾਜਧਾਨੀ ਕਹਿ ਸਕਦੇ ਹਨ ਮਾਲਵੇ ਨੂੰ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਹੈਗੀਆਂ ਅੱਜ ਹਰ ਇੱਕ ਬੰਦਾ ਜਿਹੜਾ ਹੈ ਗਰੀਬ ਤੋਂ ਗਰੀਬ ਉੱਥੇ ਜਾ ਕੇ ਇਲਾਜ ਕਰਵਾ ਸਕਦਾ ਬਹੁਤ ਵੱਡੀ ਸਹੂਲਤ ਆ ਸਾਡੇ ਏਰੀਏ ਦੇ ਲੋਕਾਂ ਨੂੰ ਦਿੱਤੀ ਹੈ ਬਹੁਤ ਸਾਰੇ ਲੋਕ ਜਿਹੜੇ ਇੱਕ ਪ੍ਰਧਾਨ ਮੰਤਰੀ ਜਿਹੜੀ ਹੈ ਇੱਕ ਯੋਜਨਾ ਹੈਗੀ ਹੈ ਜਿਹਨੂੰ ਉਹ ਕਾਮ ਸਾਡੇ ਮਤਲਬ ਜਿਹੜੇ ਮੋਦੀ ਵਾਲਾ ਕਾਰਡ ਵੀ ਕਹਿ ਦਿੰਦੇ ਹਾਂ ਆਯੁਸ਼ਮਾਨ ਕਾਰਡ ਉਸ ਦੇ ਉੱਤੇ ਪੰਜ ਲੱਖ ਤੱਕ ਦਾ ਫਰੀ ਇਲਾਜ ਹੈ ਉਹ ਕਰਾ ਸਕਦੇ ਉਹ ਵੀ ਉੱਥੇ ਅਵੇਲੇਬਲ ਹੈਗਾ ਅਤੇ ਹਰੇਕ ਆਮ ਬੰਦਾ ਉੱਥੇ ਇਲਾਜ ਕਰਵਾ ਸਕਦਾ ਬਹੁਤ ਵਧੀਆ ਇਹ ਮਤਲਬ ਹੈਗਾ ਤਾਂ ਬਹੁਤ ਬਠਿੰਡਾ ਕਾਫੀ ਡਿਵੈਲਪ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੇ ਸਾਡੇ ਲੋਕਾਂ ਵਾਸਤੇ

ਥਰਮਲਾਂ ਬਾਰੇ ਨਾ ਜੀ ਦੇਖੋ ਦੇਖੋ ਲੋਕਾਂ ਨੂੰ ਇੱਕ ਚੀਜ਼ ਤਾਂ ਕਲੀਅਰ ਹੈਗੀ ਹੈ ਵੀ ਲੋਕਾਂ ਨੂੰ ਸਹੂਲਤਾਂ ਜਿਹੜੀਆਂ ਮਿਲਦੀਆਂ ਉੱਥੇ ਕਿਤੇ ਨਾ ਕਿਤੇ ਸਾਨੂੰ ਕੁਛ ਨਾ ਕੁਛ ਤਾਂ ਪੇ ਕਰਨਾ ਪੈਂਦਾ ਪਰ ਜੇ ਅਸੀਂ ਉਹਨਾਂ ਚੀਜ਼ਾਂ ਦਾ ਬਕਾਇਦਾ ਤੌਰ ਦੇ ਉੱਤੇ ਖਿਆਲ ਰੱਖਦੇ ਹੈਗੇ ਹਾਂ ਜੋ ਉਹਨੇ ਇੰਸਟਰਕਸ਼ਨ ਹੈਗੀਆਂ ਗਵਰਮੈਂਟ ਉਹਦੇ 'ਤੇ ਕੰਟਰੋਲ ਕਰਦੀ ਹੈ ਪੋਲਿਊਸ਼ਨ ਦੇ ਉੱਤੇ ਅਤੇ ਹੋਰ ਉੱਥੇ ਦਾ ਕੋਈ ਨੁਕਸਾਨ ਨਹੀਂ ਹੈਗਾ ਮਤਲਬ ਲੋਕਾਂ ਨੂੰ ਬਿਜਲੀ ਚੌਵੀ ਘੰਟੇ ਮਿਲਣੀ ਸ਼ੁਰੂ ਹੋ ਗਈ ਹੈ ਜੀ ਇਹ ਪਹਿਲਾਂ ਲੋਕਾਂ ਨੂੰ ਪਿੰਡਾਂ 'ਚ ਬਿਜਲੀ ਹੁੰਦੀ ਨਹੀਂ ਸੀ ਫਿਰ ਹੌਲੀ ਹੌਲੀ ਬਿਜਲੀ ਆਈ ਸੀ ਇਹ ਬਠਿੰਡਾ ਥਰਮਲ ਪਲਾਂਟ ਜੀ ਮਤਲਬ ਕਾਰਗੁਜ਼ਾਰੀ ਹੈਗੀ ਵੀ ਉਹਨੇ ਬਿਜਲੀ ਦਿੱਤੀ ਉਸ ਤੋਂ ਬਾਅਦ ਮਤਲਬ ਉੱਥੇ ਸਾਡੇ ਨੇੜੇ ਲਹਿਰਾ ਥਰਮਲ ਆਪਣਾ ਨੇੜੇ ਲਹਿਰਾ ਥਰਮਲ ਪਲਾਂਟ ਹੈਗਾ ਉੱਥੇ ਵੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਨਾਂ ਦੇ ਉੱਤੇ ਜਿਹੜਾ ਥਰਮਲ ਲੱਗਿਆ ਤੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੈ

ਬਾਕੀ ਬਠਿੰਡੇ 'ਚ ਨਾ ਜੀ ਹੋਰ ਬਹੁਤ ਸਾਰੀਆਂ ਸਹੂਲਤਾਂ ਹੈਗੀਆਂ ਜਿਵੇਂ ਮਤਲਬ ਪਾਵਰ ਹਾਊਸ ਰੋਡ ਦੇ ਉੱਤੇ ਬਹੁਤ ਸਾਰਾ ਮਤਲਬ ਸਿਸਟਮ ਵਧੀਆ ਡਿਵੈਲਪ ਹੋ ਰਹੀ ਹੈ ਮਤਲਬ ਜਿਹੜੀ ਹੈ ਮਾਰਕੀਟ ਹੈਗੀ ਹੈ ਅਜੀਤ ਰੋਡ ਨੂੰ ਅਸੀਂ ਹੱਬ ਕਹਿ ਸਕਦੇ ਹਾਂ ਆਈਲੈਟਸ ਸੈਂਟਰ ਵੀ ਸਾਡੇ ਬੱਚੇ ਜਿਹੜੇ ਮਤਲਬ ਇੱਥੋਂ ਆਈਲੈਟਸ ਕਰ ਕੇ ਵਿਦੇਸ਼ਾਂ ਨੂੰ ਜਾ ਰਹੇ ਹੈ ਅਤੇ ਬੱਚੇ ਕਾਫੀ ਸੈੱਟ ਹੋ ਰਹੇ ਆ ਕਿਉਂਕਿ ਇੱਥੇ ਰੁਜ਼ਗਾਰ ਦੀ ਘਾਟ ਹੈਗੀ ਕਿਸੇ ਹੱਦ ਤੱਕ ਸਾਡੇ ਪੰਜਾਬ ਦੇ ਅੰਦਰ ਨਸ਼ਿਆਂ ਦੀ ਦਲਦਲ 'ਚ ਨੌਜਵਾਨ ਫਸਦੇ ਅਤੇ ਮਾ ਪੇਰੈਂਟਸ ਦਾ ਇਹ ਫਿਕਰਮੰਦੀ ਬਣਦੀ ਹੈ ਅਤੇ ਪੇਰੈਂਟਸ ਆਪਣੇ ਆਪ ਨੂੰ ਅੱਗੇ ਕਰਨ ਵਾਸਤੇ ਜਾਂ ਆਪਣੀ ਮਤਲਬ ਬੇਰੁਜ਼ਗਾਰੀ ਦਲਦਲ 'ਚੋਂ ਗਰੀਬੀ ਦੀ ਦਲਦਲ 'ਚੋਂ ਨਿਕਲਣ ਵੱਲ ਚਲਦੇ ਨੌਜਵਾਨ ਬੱਚੇ ਬੱਚੀਆਂ ਨੂੰ ਆਈਲੈਟਸ ਕਰਾ ਕੇ ਬਾਹਰ ਭੇਜ ਰਹੇ ਆ ਬਠਿੰਡੇ 'ਚ ਕਾਫੀ ਤੁਸੀਂ ਕਹਿ ਸਕਦੇ ਹੋ ਜੀ ਬਠਿੰਡਾ ਮਤਲਬ ਪਹਿਲਾਂ ਵਾਲਾ ਨਹੀਂ ਰਿਹਾ ਜਾਣੀ ਅੱਜ ਤੋਂ ਜੇ ਅਸੀਂ ਪੰਜਾਹ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਬਠਿੰਡਾ ਉਹਦੇ ਨਾਲੋਂ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕਿਆ ਅਤੇ ਸਾਡੇ ਲੋਕਾਂ ਵਾਸਤੇ ਬੜੀ ਵਧੀਆ ਗੱਲ ਹੈ ਜੀ

ਜੀ ਬਹੁਤ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਤੁਸੀਂ ਦੇਖੋ ਜੀ ਚੌਥਾ ਥੰਮ ਹੈ ਜੀ ਲੋਕਤੰਤਰ ਦਾ ਜਿਹੜਾ ਮੀਡੀਆ ਹੈਗਾ ਤੁਸੀਂ ਬਹੁਤ ਵਧੀਆ ਇੱਕ ਉਪਰਾਲਾ ਕੀਤਾ ਸਾਡੇ ਤੱਕ ਅਪਰੋਚ ਕਰਨ ਦਾ ਲੋਕਾਂ ਦੀ ਸਮੱਸਿਆ ਨੂੰ ਸੁਣਨ ਦਾ ਕਹਿ ਲਓ ਜਾਂ ਲੋਕਾਂ ਦੀਆਂ ਜਿਹੜੀਆਂ ਹੱਲ ਹੋ ਰਹੀਆਂ ਸਮੱਸਿਆਵਾਂ ਉਹਨਾਂ ਨੂੰ ਉਭਾਰਨ ਦਾ ਅਤੇ ਅ ਸਰਕਾਰ ਨੂੰ ਉਤਸ਼ਾਹਿਤ ਕਰਨ ਦਾ ਇਸ ਗੱਲ ਵਾਸਤੇ ਵੀ ਲੋਕਾਂ ਦਾ ਭਲਾ ਹੋ ਸਕੇ ਲੋਕਾਂ ਦਾ ਫਾਇਦਾ ਹੋ ਸਕੇ ਅਤੇ ਇਹਦੇ ਲਈ ਮੈਂ ਤੁਹਾਡਾ ਵਿਸ਼ੇਸ਼ ਧੰਨਵਾਦ ਕਰਦਾ ਥੈਂਕਯੂ ਸੋ ਮੱਚ ਜੀ ਥੈਂਕਯੂ ਓਕੇ ਜੀ ਥੈਂਕਯੂ